ਖੇਡਾਂ ਵਿੱਚ ਸਫਲਤਾ ਅਤੇ ਅਸਫਲਤਾ ਦੋਨੋਂ ਹੀ ਹੁੰਦੀਆਂ ਹਨ ਜਿਵੇਂ ਕਿ ਸਫਲਤਾ ਮਿਲਦੀ ਹੈ ਸਾਨੂੰ ਆਪਣੀ ਹੀ ਮਿਹਨਤ ਅਤੇ ਅਸੀਂ ਸਫਲਤਾ ਜਦੋਂ ਸਫਲ ਹੋ ਜਾਦੇ ਹਾਂ ਜਿੱਤ ਜਾਂਦੇ ਹਾਂ ਅਤੇ ਅਸੀਂ ਬਹੁਤ ਹੀ ਖੁਸ਼ ਹੋ ਜਾਂਦੇ ਹਾਂ ਅਤੇ ਜਦੋਂ ਅਸੀਂ ਅਸਫਲ ਹੋ ਜਾਂਦੇ ਹਾਂ ਜਿਵੇਂ ਕਿ ਹਾਰ ਜਾਂਦੇ ਹਾਂ ਅਤੇ ਸਾਨੂੰ ਬਹੁਤ ਹੀ ਬੁਰਾ ਲੱਗਦਾ ਹੈ ਫਿਰ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਖੇਡਣਾ ਹੀ ਨਹੀਂ ਚਾਹੀਦਾ ਪਰ ਨਹੀਂ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਜ਼ਿੰਦਗੀ 'ਚ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਹੈ ਜੇ ਆਪਾਂ ਜਿੱਤੇ ਹਾਂ ਅਤੇ ਹਾਰਨਾ ਵੀ ਹੈ ਅਤੇ ਜੇ ਆਪਾਂ ਹਾਰੇ ਹਾਂ ਅਤੇ ਫਿਰ ਜਿੱਤਣਾ ਵੀ ਹੈ ਅਤੇ ਇਸ ਕਰਕੇ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੱਤ ਹੀ ਹਾਰ ਅਤੇ ਹਾਰ ਹੀ ਜਿੱਤ ਹੁੰਦੀ ਹੈ ਸਾਨੂੰ ਹਾਰ ਕੇ ਵੀ ਜਿੱਤਣਾ ਚਾਹੀਦਾ ਹੈ ਇਸ ਲਈ ਸਾਨੂੰ ਹਮੇਸ਼ਾਂ ਨਿਰਾਸ਼ ਨਹੀਂ ਹੋਣਾ ਚਾਹੀਦਾ ਹਾਰ ਕੇ ਫਿਰ ਦੁਬਾਰਾ ਜਿਸ ਤਰ੍ਹਾਂ ਇੱਕ ਵਾਰਾ ਡਿੱਗ ਕੇ ਦੁਬਾਰਾ ਉੱਠਣਾ ਏ ਇਸੇ ਲਈ ਆਪਾਂ ਜੇ ਹਾਰੇ ਹਾਂ ਅਤੇ ਉਸ ਨੂੰ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੱਤਣ ਦੀ